ਵੈਸੇ ਤਾਂ ਮੇਰੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਆਦਤਾਂ ਹਨ ਜੋ ਮੈਂ ਡਰੋਇੰਗ ਕਰਦੇ ਸਮੇਂ ਸਿਰਜਨਾਤਮਕ ਖੇਤਰ ਵਿੱਚ ਜਾਣ ਲਈ ਵਰਤਦੀ ਹਾਂ ਵੈਸੇ ਸਿੰਗਿੰਗ ਮੈਨੂੰ ਬਹੁਤ ਪਸੰਦ ਹੈ ਮੈਂ ਸੰਗੀਤ ਸੁਣਦੀ ਹਾਂ ਅਤੇ ਉਸਨੂੰ ਮਨਨ ਵੀ ਕਰਦੀ ਹਾਂ ਅਤੇ ਸੰਗੀਤ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਸੰਗੀਤ ਮੈਨੂੰ ਇੰਨਾ ਕੁ ਜ਼ਿਆਦਾ ਪਸੰਦ ਹੈ ਕਿ ਮੈਂ ਬਚਪਨ ਤੋਂ ਹੀ ਸਿੰਗਿੰਗ ਕਰਦੀ ਆ ਰਹੀ ਹਾਂ ਅਤੇ ਡਰੋਇੰਗ ਕਰਦੇ ਸਮੇਂ ਸੰਗੀਤ ਤੋਂ ਇਲਾਵਾ ਮੈਂ ਮਤਲਬ ਸੰਗੀਤ ਨੂੰ ਆਪਣੇ ਮਨ ਵਿੱਚ ਗੁਣਗੁਣਾਉਂਦੀ ਹਾਂ ਅਤੇ ਕਈ ਵਾਰ ਮਤਲਬ ਸ ਡਰੋਇੰਗ ਕਰਦੇ ਸਮੇਂ ਮੈਂ ਡਾਂਸ ਵੀ ਕਰ ਲੈਂਦੀ ਹਾਂ ਅਤੇ ਸਿੰਗਿੰਗ ਤਾਂ ਮੇਰਾ ਹੈ ਹੀ ਹੈ ਬਟ ਡਾਂਸਿੰਗ ਵੀ ਥੋੜ੍ਹੀ ਬਹੁਤ ਹੋ ਜਾਂਦੀ ਹੈ ਲੇਕਿਨ ਜੋ ਮੇਰੀ ਕਲਾਤਮਕ ਪ੍ਰੇਰਨਾ ਅਤੇ ਮੇਰੇ ਫੋਕਸ ਨੂੰ ਜਗਾਉਣ ਲਈ ਜੋ ਮੈਂ ਪੇਂਟਿੰਗਸ ਕਰਦੇ ਸਮੇਂ ਕਰਦੀ ਹਾਂ ਮੇਰੇ ਅੰਦਰ ਜੁ ਪ੍ਰੇਰਨਾ ਅਤੇ ਫੋਕਸ ਨੂੰ ਜਗਾਉਣ ਵਿੱਚ ਮਦਦ ਕਰਦੀ ਹੈ ਉਹ ਸਿਰਫ਼ ਔਰ ਸਿਰਫ਼ ਸਿੰਗਿੰਗ ਹੈ ਅਤੇ ਸੰਗੀਤ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹੈ ਸਿੰਗਿੰਗ ਇਜ਼ ਮਾਏ ਫੇਵਰੇਟ ਪੈਸ਼ਨ